ਖਾਣਾ ਪਕਾਉਣ ਵਿੱਚ ਅਸੀਂ ਬਰਤਨ ਵਰਤਦੇ ਹਾਂ ਕੁੱਕਰ ਪਤੀਲਾ ਕੜਾਹੀ ਕੁਛ ਵੀ ਐਸਾ ਵਰਤਦੇ ਹਾਂ ਜੋ ਕਿ ਸਾਨੂੰ ਆਸਾਨ ਖਾਣਾ ਆਸਾਨ ਬਣ ਜਾਂਦਾ ਉਸ ਵਿੱਚ ਜੋ ਕਿ ਅਸੀਂ ਖਾਣਾ ਅਸੀਂ ਉਸ ਵਿੱਚ ਬਣਾ ਸਕਦੇ ਹਾਂ ਤਾਂ ਕਿ ਬਰਤਨ ਹੀ ਇਹੀ ਯੂਜ ਹੁੰਦੇ ਹੈ ਅਸੀਂ ਖਾਣਾ ਪਕ ਬਣਾਉਣ ਵੇਲੇ ਹੋਰ ਕੁਛ ਯੂਜ ਹੀ ਨਹੀਂ ਕਰ ਸਕਦੇ ਇਸ ਤੋਂ ਬਿਨਾਂ ਕੁੱਕਰ ਹੋ ਗਿਆ ਕੜਾਹੀ ਪਤੀਲਾ ਹੋਰ ਵੀ ਕੁਛ ਵੀ ਐਸਾ ਪਤੀਲਾ ਹੀ ਹੁੰਦਾ ਹੈ ਵਰਤਣ ਨੂੰ ਕਿਉਂਕਿ ਅਸੀਂ ਇਹਦੇ ਵਿੱਚ ਆ ਕੁੱਕਰ ਵਿੱਚ ਜਲਦੀ ਖਾਣਾ ਬਣ ਜਾਂਦਾ ਹੈ ਜਲਦੀ ਉਹ ਕੋਈ ਵੀ ਗੈਸਟ ਪ੍ਰੋਹਣਾ ਆਇਆ ਹੋਏ ਫਿਰ ਅਸੀਂ ਕੁੱਕਰ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਕਿ ਜਲਦੀ ਖਾਣਾ ਪੱਕ ਜਾਏ ਅਤੇ ਜੇ ਨਹੀਂ ਗੈਸਟ ਆਇਆ ਤਾਂ ਫਿਰ ਅਸੀਂ ਜਿਹੜੀ ਸੁੱਕੀ ਸਬਜ਼ੀ ਹੈ ਉਹ ਕੜਾਹੀ ਵਿੱਚ ਬਣਾਉਣ ਨੂੰ ਬਣਾਉਂਦੇ ਹਾਂ ਕੁੱਕਰ ਵਿੱਚ ਦਾਲ ਵਗੈਰਾ ਬਣਦੀ ਹੈ ਹਰ ਇੱਕ ਚੀਜ਼ ਕੁੱਕਰ ਵਿੱਚ ਰਾਜਮਾਹ ਚਣੇ ਦਾਲ ਕੁੱਕਰ ਵਿੱਚ ਬਣਦੀ ਹੈ ਤਾਂ ਹੀ ਉਹਨੂੰ ਵਰਤਦੇ ਹਾਂ ਕੜਾਹੀ ਵਿੱਚ ਵੀ ਸੁੱਕੀਆਂ ਸਬਜ਼ੀਆਂ ਬਣਦੀਆਂ ਅਸੀਂ ਉਹਨੂੰ ਵਰਤਦੇ ਹਾਂ ਪਤੀਲੇ ਵਿੱਚ ਵੀ ਚੌਲ ਵਗੈਰਾ ਬਣਾਉਂਦੇ ਹਾਂ ਉਹ ਬਰਤਨ ਉਹ ਵੀ ਯੂਜ ਹੁੰਦਾ ਹੈ ਕੁਛ ਵੀ ਪਤੀਲਾ ਬਰਤਨ ਇਹੀ ਯੂਜ ਹੁੰਦੇ ਹੈ ਮਤਲਬ ਭਾਂਡੇ ਇਸ ਕਰਕੇ ਅਸੀਂ ਇਹਨਾਂ ਨੂੰ ਯੂਜ ਵਰਤਦੇ ਹਾਂ ਖਾਣਾ ਪਕਾਉਣ ਵੇਲੇ ਅਸੀਂ ਇਹਨਾਂ ਨੂੰ ਯੂਜ ਕਰਦੇ ਹਾਂ ਫੁਲਕੇ ਬਣਾਉਣ ਟਾਈਮ ਅਸੀਂ ਚਕਲਾ ਵੇਲਣਾ ਯੂਜ ਕਰ ਕਰਦੇ ਹਾਂ ਅਤੇ ਖਾਣਾ ਬਣਾਉਣ ਵਿੱਚ ਇਹੀ ਬਰਤਨ ਤਿੰਨ ਹੁੰਦੇ ਆ ਕੜਾਹੀ ਪਤੀਲਾ ਅਤੇ ਕੁੱਕਰ ਅਤੇ ਕੜਸ਼ੀਆਂ ਵਗੈਰਾ ਇਹੀ ਹੁੰਦੇ ਆ